ਹੈਲੋ ਹਾਂਜੀ ਤੁਸੀਂ ਬਥੇਜਾ ਫੁੱਟਵੇਅਰ ਹਾਊਸ ਤੋਂ ਗੱਲ ਕਰ ਰਹੇ ਹੋ ਹਾਂਜੀ ਮੈਮ ਤੁਹਾਡੇ ਕੋਲ ਕੀ ਕੀ ਮਿਲ ਜਾਣਗੇ ਸ਼ੂਜ ਵਗੈਰਾ ਚੱਪਲ ਜੁੱਤੀ ਬੈਲੀ ਵਗੈਰਾ ਦੀ ਕੀ ਕੀ ਕੁਆਲਿਟੀਜ਼ ਹੈ ਕੀ ਕੀ ਕੰਪਨੀ 'ਚ ਮਿਲ ਜਾਣਗੇ ਅਤੇ ਮੈਨੂੰ ਸ਼ੂਜ ਮਤਲਬ ਵਗੈਰਾ ਬਾਰੇ ਦੱਸੋਗੇ ਕਿ ਕਿਹੜੀਆਂ ਤੁਹਾਡੇ ਕੋਲ ਕੰਪਨੀਜ਼ ਹੈਗੀਆਂ ਨੇ ਹਾਂਜੀ ਤੁਹਾਡੇ ਕੋਲ ਐਡੀਡਸ ਦੇ ਸ਼ੂਜ ਮਿਲ ਜਾਂਦੇ ਹੈ ਅਤੇ ਉਹਦੇ 'ਚ ਸੱਤ ਨੰਬਰ ਹੋਵੇਗਾ ਹਾਂਜੀ ਅਤੇ ਤੁਹਾਡੀ ਸ਼ੋਪ 'ਤੇ ਰਸ਼ ਕਦੋਂ ਨਹੀਂ ਹੁੰਦਾ ਉਦੋਂ ਮੈਂ ਆਵਾਂ ਓਕੇ ਠੀਕ ਹੈ ਅਤੇ ਉਹਦੇ ਸ਼ੂਜ ਦੇ ਚਾਰਜੀਸ ਕੀ ਹੋਣਗੇ ਰੇਟ ਕੀ ਕੀ ਨੇ ਹਾਂਜੀ ਅਤੇ ਮੈਮ ਜਿਹੜੇ ਦੂਜੇ ਸ਼ੂਜ ਆਉਂਦੇ ਅੱਜ ਕੱਲ੍ਹ ਹੀਲ ਵਾਲੇ ਲੋਂਗ ਸ਼ੂਜ ਆ ਉਹਨਾਂ ਦਾ ਕੀ ਰੇਟ ਹੈ ਤੁਹਾਡੇ ਕੋਲੋਂ ਤੁਹਾਡੇ ਕੋਲੋਂ ਮੇਲ ਦੇ ਵੀ ਮਿਲ ਜਾਂਦੇ ਸ਼ੂਜ ਬੱਚਿਆਂ ਦੇ ਵੀ ਅਤੇ ਬੱਚਿਆਂ ਵਿੱਚ ਸ਼ੂਜ ਦੀਆਂ ਜਿਵੇਂ ਵੱਧ ਵੱਖਰੀਆਂ ਵੱਖਰੀਆਂ ਹੁੰਦੀਆਂ ਵਰਾਇਟੀਆਂ ਉਹ ਵੀ ਮਿਲ ਜਾਂਦੀਆਂ ਜਿਵੇਂ ਹੁਣ ਛੋਟੇ ਬੱਚੇ ਹੈਗੇ ਉਹਨਾਂ ਨੂੰ ਉਹ ਲਾਈਟ ਚੱਲੇ ਜ਼ਿਆਦਾ ਮੀਨਸ ਪਸੰਦ ਕਰਦੇ ਆ ਸ਼ੂਜ ਮੇਰੀ ਗੁੱਡੂ ਹੈਗੀ ਆ ਛੋਟੀ ਉਹਨੂੰ ਚਾਹੀਦੇ ਹੈ ਉਹਦੇ ਵਾਸਤੇ ਲੈਣੇ ਸੀ ਹਾਂਜੀ ਅਤੇ ਹੋਰ ਤੁਹਾਡੇ ਕੋਲੋਂ ਬੈਲੀਸ ਵਗੈਰਾ ਵਿੱਚ ਹਾਂਜੀ ਅਤੇ ਕੁਆਲਿਟੀ ਵਗੈਰਾ ਵਿੱਚ ਕੋਈ ਨਹੀਂ ਨਹੀਂ ਰੂਟੀਨ ਵਾਈਸ ਹੀ ਚਾਹੀਦਾ ਡੇਲੀ ਲਈ ਹਾਂਜੀ ਜੀ ਅਸੀਂ ਦੋ ਮੈਮ ਮੈਂ ਅੱਜ ਸ਼ਾਮੀ ਆਵਾਂਗੀ ਅਤੇ ਰੇਟਾਂ ਦਾ ਕਿਵੇਂ ਹਿਸਾਬ ਹੈ ਦੋ ਤਿੰਨ ਸ਼ੂਜ ਦੇ ਜੋੜੇ ਹੋਰ ਜ਼ਿਆਦਾ ਲਈਏ ਤਾਂ ਰੇਟ ਦਾ ਕੀ ਹਿਸਾਬ ਰਹੇਗਾ ਠੀਕ ਆ ਮੈਮ ਠੀਕ ਆ ਮੈਮ ਧੰਨਵਾਦ ਹਾਂਜੀ